ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਔਰ ਪੰਜਾਬੀ ਲੋਕ ਆਪਣੀ ਪਛਾਣ ਅਤੇ ਸੰਬੰਧਿਤ ਦੀ ਭਾਵਨਾ ਪ੍ਰਾਪਤ ਕਰਨ ਲਈ ਆਪਣੀ ਭਾਸ਼ਾ ਦੀ ਵਰਤੋਂ ਇੱਦਾਂ ਕਰਦੇ ਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਲੋਕ ਪੰਜਾਬੀ ਬੋਲਦੇ ਆ ਪਿਓਰ ਪੰਜਾਬੀ ਬੋਲਦੇ ਆ ਔਰ ਜਿਸ ਤਰ੍ਹਾਂ ਕਿ ਪਠਾਨਕੋਟ ਵਿੱਚ ਥੋੜ੍ਹੀ ਜਿਹੀ ਪੰਜਾਬੀ ਨੂੰ ਹੋਰ ਤਰੀਕੇ ਨਾਲ ਬੋਲ ਜਾ ਬੋਲਿਆ ਜਾਂਦਾ ਔਰ ਬਟਾਲੇ ਵਿੱਚ ਜਿਸ ਤਰ੍ਹਾਂ ਮੈਂ ਹੋਰ ਤਰ੍ਹਾਂ ਬੋਲਿਆ ਜਾਂਦਾ ਜਿਸ ਤਰ੍ਹਾਂ ਪੰਜਾਬੀ ਗੁਰਦਾਸਪੁਰ ਸ਼ਹਿਰ ਵਿੱਚ ਮੈਂ ਤੂੰ ਅਸੀਂ ਕਰਕੇ ਇਸ ਤਰ੍ਹਾਂ ਕਰਕੇ ਬੋਲਿਆ ਜਾਂਦਾ ਫਿਰ ਸਸਰੀਕਾਲ ਨੂੰ ਵੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਇਸ ਤਰ੍ਹਾਂ ਕਈ ਅਲੱਗ ਅਲੱਗ ਤਰੀਕਿਆਂ ਨਾਲ ਬੋਲਿਆ ਜਾਂਦਾ ਪੰਜਾਬੀ ਇੰਨੀ ਸੌਖੀ ਹੈ ਕਿ ਕਿਸੇ ਵੀ ਇਨਸਾਨ ਨੂੰ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਬੋਲੀ ਜਾਂਦੀ ਹੈ ਮੈਂ ਇੰਗਲਿਸ਼ ਵਿੱਚ ਤਾਂ ਲੋਕ ਬਹੁਤ ਜ਼ਿਆਦਾ ਅੜਦੇ ਬੋਲਣ ਵਿੱਚ ਸਮਝ ਨਹੀਂ ਆਉਂਦੀ ਬੱਚਿਆਂ ਨੂੰ ਲੇਕਿਨ ਪੰਜਾਬ ਨੂੰ ਪੰਜਾਬੀ ਨੂੰ ਲੋਕ ਬਹੁਤ ਬੱਚੇ ਵੀ ਬਹੁਤ ਵਧੀਆ ਤਰੀਕੇ ਨਾਲ ਬੋਲ ਲੈਂਦੇ ਇਸ ਕਰਕੇ ਪੰਜਾਬੀ ਗੁਰਦੁਆਰਿਆਂ ਵਿੱਚ ਵੀ ਬਹੁਤ ਵਧੀਆ ਬੋਲੀ ਜਾਂਦੀ ਆ ਉੱਥੇ ਪੰਜਾਬੀ ਬੋਲਣ ਵਾਸਤੇ ਕਹਿੰਦੇ ਆ ਔਰ ਜਿਸ ਤਰ੍ਹਾਂ ਮਾਝੇ ਦੀ ਮਾ ਮਾਲਵੇ ਜੀ ਮਲਵਈ ਭਾਸ਼ਾ ਇਸ ਤਰ੍ਹਾਂ ਹਰ ਸਥਾਨ ਦੀ ਆਪੋ ਆਪਣੀ ਹੁੰਦੀ ਹੈ ਔਰ ਪੰਜਾਬ ਦੀ ਤਾਂ ਬਹੁਤ ਵਧੀਆ ਭਾਸ਼ਾ ਹੈ ਪੰਜਾਬੀ ਔਰ ਸਾਨੂੰ ਵੀ ਬਹੁਤ ਜ਼ਿਆਦਾ ਵਧੀਆ ਪੰਜਾਬੀ ਲੱਗਦੀ ਆ ਅਸੀਂ ਆਪਣੇ ਘਰ ਵਿੱਚ ਹਾਂਜੀ ਜੀ ਬੱਚੇ ਇਸ ਤਰ੍ਹਾਂ ਬੋਲਦੇ ਆ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕੋਈ ਵੀ ਆਏ ਘਰ ਔਰ ਇਸ ਤਰ੍ਹਾਂ ਬੋਲਦੇ ਹਾਂ ਬਹੁਤ ਵਧੀਆ ਲੱਗਦਾ ਓਕੇ ਥੈਂਕ